ਜੇਕਰ ਗੱਲ ਕਰੀਏ ਭਾਰਤੀ ਆਵਾਜਾਈ ਪ੍ਰਣਾਲੀ ਦੀ ਤਾਂ ਪਹਿਲਾਂ ਪਹਿਲਾਂ ਆਵਾਜਾਈ ਦਾ ਇੰਨਾਂ ਚੰਗਾ ਪ੍ਰਬੰਧ ਨਹੀਂ ਹੁੰਦਾ ਸੀ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਔਖਾ ਸੀ ਕਿਉਂਕਿ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀਗੇ ਤਾਂ ਹੌਲੀ ਹੌਲੀ ਸਮਾਂ ਬਦਲਦਾ ਗਿਆ ਅਤੇ ਇਹਨਾਂ ਦੇ ਵਿੱਚ ਪਹਿਲਾਂ ਸਾਈਕਲ ਦਾ ਨਿਰਮਾਣ ਹੋਇਆ ਪਹਿਲਾਂ ਲੋਕ ਸਾਈਕਲ 'ਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲੱਗੇ ਫਿਰ ਆਵਾਜਾਈ ਦੇ ਸਾਧਨਾਂ ਵਿੱਚ ਹੋਰ ਤਰੱਕੀ ਕੀਤੀ ਗਈ ਸੜਕਾਂ ਬਣਾਈਆਂ ਗਈਆਂ ਅਤੇ ਸੜਕਾਂ ਦੇ ਨਾਲ ਨਾਲ ਪਿੰਡਾਂ ਜਿਵੇਂ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਵਾਸਤੇ ਸਰਕਾਰੀ ਬੱਸਾਂ ਚਲਾਈਆਂ ਗਈਆਂ ਇਹਦੇ ਨਾਲ ਕੀ ਹੁੰਦਾ ਸੀਗਾ ਕਿ ਲੋਕ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਜਾਣ ਲੱਗੇ ਉਸ ਤਰੀਕੇ ਨਾਲ ਫਿਰ ਬੜੇ ਬੜੇ ਹਾਈਵਿਆਂ ਦਾ ਨਿਰਮਾਣ ਕੀਤਾ ਗਿਆ ਇੰਟਰਨੈਸ਼ਨਲ ਹਾਈਵੇ ਬਣੇ ਤਾਂ ਜੋ ਬੜੇ ਬੜੇ ਸ਼ਹਿਰਾਂ ਨਾਲ ਛੋਟੇ ਸ਼ਹਿਰਾਂ ਦਾ ਲਿੰਕ ਹੋ ਸਕੇ ਅਤੇ ਬਿਜ਼ਨਸ ਜਿਵੇਂ ਕੋਈ ਚੀਜ਼ ਸਮਾਨ ਵੇਚਣਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਸਮਾਨ ਵੇਚਣਾ ਤਾਂ ਉਹਦੇ ਵਿੱਚ ਓਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਾਈਵਿਆਂ ਦਾ ਨਿਰਮਾਣ ਕੀਤਾ ਗਿਆ ਫਿਰ ਇਸੇ ਤਰੀਕੇ ਨਾਲ ਲੋਕ ਅਮੀਰ ਬਣਦੇ ਗਏ ਅਤੇ ਉਹਨਾਂ ਨੇ ਆਪਣੇ ਸਾਧਨ ਖਰੀਦਣਾ ਸ਼ੁਰੂ ਕਰਤਾ ਫਿਰ ਜਦੋਂ ਆਪਣੇ ਸਾਧਨ ਹੋ ਗਏ ਤਾਂ ਲੋਕ ਫਿਰ ਆਪਣੇ ਸਾਧਨਾਂ 'ਤੇ ਟਰੈਵਲ ਕਰਨ ਲੱਗੇ ਜਿਵੇਂ ਕਾਰਾਂ ਹੋਗੀਆਂ ਗੱਡੀਆਂ ਹੋਗੀਆਂ ਹੈ ਨਾ ਇਹ ਚਲਾਉਣ ਲੱਗ ਗਏ ਫਿਰ ਇਹਦੇ ਨਾਲ ਕੀ ਹੋਇਆ ਜਿਵੇਂ ਦੌਰ ਅੱਗੇ ਵੱਧਦਾ ਗਿਆ ਲੋਕ ਅਮੀਰ ਹੁੰਦੇ ਗਏ ਅਤੇ ਆਪਣੇ ਆਪਣੇ ਸਾਧਨ 'ਤੇ ਉਹ ਇੱਕ ਥਾਂ ਤੋਂ ਦੂਜੀ ਥਾਂ ਜਾਣ ਲੱਗੇ ਫਿਰ ਜਦੋਂ ਇਦਾਂ ਚੱਲਦਾ ਰਿਹਾ ਥੋੜ੍ਹੇ ਸਾਲਾਂ ਬਾਅਦ ਸਾਡੀ ਟਰੈਫਿਕ ਦੀ ਜਿਹੜੀ ਸਮੱਸਿਆ ਸਾਹਮਣੇ ਆਉਣ ਲੱਗੀ ਫਿਰ ਇਹ ਸਮੱਸਿਆ ਨੂੰ ਸੋਲਵ ਕਰਨ ਵਾਸਤੇ ਤਾਂ ਹੁਣ ਫਿਰ ਦੁਬਾਰਾ ਸਰਕਾਰ ਨੇ ਕੀ ਕੀਤਾ ਕਿ ਕੁਛ ਯੋਜਨਾਵਾਂ ਦਾ ਨਿਰਮਾਣ ਕੀਤਾ ਜਿਵੇਂ ਮੈਟਰੋ ਗੱਡੀਆਂ ਚਲਾ ਲਈਆਂ ਜਾਂ ਟ੍ਰੇਨਾਂ 'ਚ ਸਫਰ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਠੀਕ ਹੈ ਜੀ ਇਸ ਚੀਜ਼ ਨੂੰ ਮਤਲਬ ਟਰੈਫਿਕ ਨੂੰ ਘਟਾਉਣ ਵਾਸਤੇ ਤਾਂ ਜੋ ਸੜਕਾਂ 'ਤੇ ਐਕਸੀਡੈਂਟ ਨਾ ਹੋਣ ਜਾਂ ਲੋਕਾਂ ਨੂੰ ਜ਼ਿਆਦਾ ਟਰੈਫਿਕ ਦੇ ਵਿੱਚ ਨਾ ਫਸਣ